ਸਾਡੇ ਪੰਜਾਬ ਵਿੱਚ ਬਹੁਤ ਸਾਰੀਆਂ ਘੁੰਮਣ ਦੀਆਂ ਥਾਵਾਂ ਹਨ ਜਿੱਥੇ ਸੈਲਾਨੀ ਆ ਸਕਦੇ ਹਨ ਜਿਵੇਂ ਕਿ ਪਟਿਆਲਾ ਸ਼ਹਿਰ ਵਿੱਚ ਸ਼ੀਸ਼ ਮਹਿਲ ਅਤੇ ਕਿਲ੍ਹਾ ਬਹੁਤ ਹੀ ਸੁੰਦਰ ਇਮਾਰਤਾਂ ਬਣੀਆਂ ਹੋਈਆਂ ਹਨ ਇਹਨਾਂ ਇਹ ਇਮਾਰਤਾਂ ਰਾਜੇ ਮਹਾਰਾਜਿਆਂ ਦੇ ਸਮੇਂ ਦੀਆਂ ਹਨ ਸ਼ੀਸ਼ ਮਹਿਲ ਵਿੱਚ ਬਹੁਤ ਸਾਰੇ ਮੇਲੇ ਲੱਗਦੇ ਹਨ ਇਹ ਮੇਲੇ ਹਰ ਸਾਲ ਲਗਾਏ ਜਾਂਦੇ ਹਨ ਇਹ ਇਮਾਰਤਾਂ ਬਹੁਤ ਹੀ ਸੁੰਦਰ ਦਿਖਾਈ ਦਿੰਦੀਆਂ ਹਨ ਇਹ ਇਮਾਰਤਾਂ ਰਾਜੇ ਮਹਾਰਾਜੇ ਦੁਆਰਾ ਬਣਾਈਆਂ ਗਈਆਂ ਹਨ ਸ਼ੀਸ਼ ਮਹਿਲ ਵਿੱਚ ਹਰ ਸਾਲ ਮੇਲਾ ਲੱਗਦਾ ਹੈ ਇਹ ਕ੍ਰਾਫਟ ਮੇਲੇ ਵਿੱਚ ਬਹੁਤ ਸਾਰੇ ਕਲਾਕਾਰ ਆਉਂਦੇ ਹਨ ਉਹ ਆਪਣੀ ਕਲਾ ਕਿਰਤੀਆਂ ਨੂੰ ਦਰਸਾਉਂਦੇ ਹਨ ਅਤੇ ਦਿਖਾਉਂਦੇ ਹਨ ਇਹ ਕਲਾ ਕਿਰਤੀਆਂ ਬਹੁਤ ਹੀ ਸੋਹਣੀਆਂ ਹੁੰਦੀਆ ਹਨ ਇੱਥੇ ਕਈ ਕਲਾਕਾਰ ਵੀ ਬੁਲਾਏ ਜਾਂਦੇ ਹਨ ਜੋ ਕਿ ਸਾਡਾ ਮੰਨੋਰੰਜਨ ਕਰਦੇ ਹਨ ਇੱਥੇ ਕਾਫੀ ਸਾਰੀਆਂ ਦੁਕਾਨਾਂ ਵੀ ਲਗਾਈ ਜਾਂਦੀਆਂ ਹਨ ਜਿਸ ਵਿੱਚ ਲੋਕ ਆਪਣੇ ਸਮਾਨ ਦਾ ਪ੍ਰਸ਼ਾਰਿਤ ਕਰਦੇ ਹਨ ਅਤੇ ਸਾਨੂੰ ਵੇਚਦੇ ਹਨ ਇਹ ਬਹੁਤ ਹੀ ਸੁੰਦਰ ਮੇਲੇ ਲਗਾਏ ਜਾਂਦੇ ਹਨ ਜਿਵੇਂ ਕਿ ਅਸੀਂ ਵੇਖ ਸਕਦੇ ਹਾਂ ਕਿ ਅੰਮ੍ਰਿਤਸਰ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਅਨੰਦਪੁਰ ਸਾਹਿਬ ਅੰਮ੍ਰਿਤਸਰ ਵਿੱਚ ਗੋਲਡਨ ਟੈਂਪਲ ਹੈ ਜਿੱਥੇ ਹਰ ਸਾਲ ਕਈ ਹਜ਼ਾਰ ਸੈਲਾਨੀ ਆਉਂਦੇ ਹਨ ਇੱਥੇ ਹਰ ਰੋਜ਼ ਕਈ ਸੈਲਾਨੀ ਹਜ਼ਾਰਾਂ ਵਿੱਚ ਆਉਂਦੇ ਹਨ ਅਤੇ ਗੁਰਦੁਆਰੇ ਵਿੱਚ ਦਰਸ਼ਨ ਕਰਦੇ ਹਨ ਇੱਥੇ ਹਰ ਸਮੇਂ ਬਹੁਤ ਹੀ ਭੀੜ ਲੱਗੀ ਰਹਿੰਦੀ ਹੈ ਇਹ ਗੁਰਦੁਆਰੇ ਵਿੱਚ ਹਰ ਇੱਕ ਵਿਅਕਤੀ ਨੂੰ ਅਤੇ ਹਰ ਇੱਕ ਸੈਲਾਨੀ ਨੂੰ ਲੰਗਰ ਛਕਾਇਆ ਜਾਂਦਾ ਹੈ ਇੱਥੇ ਸਭ ਨਾਲੋਂ ਵੱਡੀ ਰਸੋਈ ਵੀ ਬਣੀ ਹੋਈ ਹੈ ਜੋ ਕਿ ਵਰਲਡ ਦੀ ਸਭ ਨਾਲੋਂ ਵੱਡੀ ਰਸੋਈ ਹੈ ਇਸ ਰਸੋਈ ਵਿੱਚ ਪਕਵਾਨ ਬਣਾਏ ਜਾਂਦਾ ਹੈ ਅਤੇ ਸਾਰੇ ਸੈਲਾਨੀਆਂ ਅਤੇ ਹੋਰ ਲੋਕਾਂ ਵਿੱਚ ਵੀ ਵੰਡਿਆ ਜਾਂਦਾ ਹੈ ਇੱਥੇ ਕਾਫੀ ਸਾਰਾ ਲੰਗਰ ਬਣਾਇਆ ਜਾਂਦਾ ਹੈ ਇਹ ਲੰਗਰ ਸਾਰੇ ਲੋਕਾਂ ਵਿੱਚ ਵੰਡਿਆ ਜਾਂਦਾ ਹੈ ਇਹ ਲੰਗਰ ਬੜੇ ਪਿਆਰ ਨਾਲ ਬਣਾਇਆ ਜਾਂਦਾ ਹੈ ਅਤੇ ਬੜੇ ਪਿਆਰ ਨਾਲ ਹੀ ਵਰਤਾਇਆ ਜਾਂਦਾ ਹੈ ਅਸੀਂ ਅੰਮ੍ਰਿਤਸਰ ਵਿੱਚ ਜਲ੍ਹਿਆਂ ਵਾਲਾ ਬਾਗ ਵੀ ਵੇਖ ਸਕਦੇ ਹਾਂ ਜਲ੍ਹਿਆਂ ਵਾਲੇ ਬਾਗ ਵਿੱਚ ਅਸੀਂ ਕਈ ਸ਼ਹੀਦਾਂ ਨੂੰ ਦੇਖ ਸਕਦੇ ਹਾਂ ਜਿਵੇਂ ਕਿ ਸ਼ਹੀਦ ਭਗਤ ਸਿੰਘ ਸ਼ਹੀਦ ਉਧਮ ਸਿੰਘ ਆਦਿ ਅਸੀਂ ਸਾਨੂੰ ਇੱਥੇ ਗੋਲੀਆਂ ਦੇ ਨਿਸ਼ਾਨ ਵੀ ਵੇਖਣ ਨੂੰ ਮਿਲਦੇ ਹਨ ਜੋ ਕਿ ਸਾਡੇ ਦਿਲ ਨੂੰ ਬਹੁਤ ਹੀ ਜ਼ਿਆਦਾ ਠਹਿਰਾਂ ਪਹੁੰਚਾਉਂਦੇ ਹਨ ਅਸੀਂ ਇੱਥੇ ਇੱਕ ਖੂਹ ਵੀ ਦੇਖਦੇ ਹਾਂ ਜਦੋਂ ਜਨਰਲ ਡਾਇਰ ਨੇ ਲੋਕਾਂ ਉੱਤੇ ਹਮਲਾ ਕੀਤਾ ਸੀ ਤਾਂ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਇਹ ਖੂਹ ਵਿੱਚ ਕੁੱਦ ਗਏ ਸਨ ਅਸੀਂ ਫਤਿਹਗੜ੍ਹ ਸਾਹਿਬ ਵਿੱਚ ਵੀ ਵੇਖ ਸਕਦੇ ਹਾਂ ਕਿ ਅੱਜ ਕੱਲ੍ਹ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਉੱਥੇ ਕਈ ਲੰਗਰ ਲਗਾਏ ਜਾਏ ਚੱਕੇ ਹਨ ਅਤੇ ਅਨੰਦਪੁਰ ਵਿੱਚ ਵੀ ਕਈ ਲੰਗਰ ਲਗਾਏ ਜਾ ਚੁੱਕੇ ਹਨ ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਇਹ ਲੰਗਰ ਛੋਟੇ ਸਾਹਿਬਜ਼ਾਦਿਆਂ ਅਤੇ ਬੜੇ ਸ ਬੜੇ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਲਗਾਇਆ ਜਾਂਦੇ ਹਨ ਅਤੇ ਸ਼ਹੀਦੀ ਜੋੜ ਮੇਲੇ ਵੀ ਲੱਗ ਰਹੇ ਹਨ ਦਸੰਬਰ ਦੇ ਆਖਰੀ ਦਿਨ ਵਿੱਚ ਇਹ ਮੇਲੇ ਲਗਾਏ ਜਾਂਦੇ ਹਨ ਇਹ ਮੇਲੇ ਸਾਡੇ ਦਿਲ ਉੱਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਪਾਉਂਦੇ ਹਨ ਕਿਉਂਕਿ ਇਹ ਮੇਲੇ ਛੋਟੇ ਸਾਹਿਬਜ਼ਾਦਿਆਂ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਾਰਨ ਲਗਾਏ ਜਾਂਦੇ ਹਨ